ਹੈਲੋ ਹੈਲੋ ਸਰ ਸਵਿਗੀ ਤੋਂ ਬੋਲ ਰਹੇ ਜੀ ਸਰ ਪਿਛਲੇ ਵੀਕ ਮੈਂ ਇੱਕ ਔਡਰ ਕੀਤਾ ਸੀਗਾ ਸਰ ਮੇਰੇ ਘਰ ਮੇਰੇ ਫਰੈਂਡ ਆਏ ਹੋਏ ਸੀ ਔਡਰ ਕਰਨ ਤੋਂ ਬਾਅਦ ਅਸੀਂ ਕਾਫ਼ੀ ਟਾਈਮ ਵੇਟ ਕਰਦੇ ਰਹੇ ਬਟ ਦਿੱਤੇ ਹੋਏ ਟਾਈਮ ਤੋਂ ਕਾਫ਼ੀ ਟਾਈਮ ਬਾਅਦ ਤੱਕ ਵੀ ਤੁਹਾਡਾ ਔਡਰ ਨਹੀਂ ਪਹੁੰਚਿਆ ਹਾਂਜੀ ਸਰ ਫਿਰ ਵੇਟ ਕਰ ਕਰਕੇ ਮੈਨੂੰ ਬਾਜ਼ਾਰੋਂ ਕੋਈ ਨਾ ਕੋਈ ਹੋਰ ਸਮਾਨ ਮੰਗਵਾਉਣਾ ਪਿਆ ਉਸ ਤੋਂ ਨੈਕਸਟ ਡੇ ਮੈਂ ਕੰਪਲੇਂਟ ਕੀਤੀ ਕਿ ਮੇਰਾ ਰਿਫੰਡ ਜਿਹੜਾ ਮੈਂ ਪੇਮੈਂਟ ਕੀਤੀ ਹੈ ਉਹ ਰਿਫੰਡ ਕੀਤਾ ਜਾਵੇ ਸਰ ਰਿਫੰਡ ਦੀ ਕੰਪਲੇਂਟ ਵੀ ਮੈਂ ਦੋ ਜਾਂ ਤਿੰਨ ਵਾਰੀ ਪਾ ਚੁੱਕਾ ਬਟ ਕੋਈ ਰਿਸਪੌਂਸ ਨਹੀਂ ਆਇਆ ਜੀ ਸਰ ਮੇਰੀ ਕਸਟਮਰ ਕੇਅਰ 'ਚ ਵੀ ਗੱਲ ਹੋ ਰਹੀ ਸੀ ਸਰ ਉਹ ਕਹਿ ਰਹੇ ਸੀ ਤੁਹਾਡਾ ਚੌਵੀ ਘੰਟੇ ਦੇ ਅੰਦਰ ਅੰਦਰ ਰਿਫੰਡ ਮਿਲ ਜਾਵੇਗਾ ਬਟ ਸਰ ਅੱਜ ਬਹੱਤਰ ਘੰਟੇ ਤੋਂ ਉੱਪਰ ਹੋ ਗਏ ਨੇ ਕੋਈ ਰਿਫੰਡ ਨਹੀਂ ਮਿਲਿਆ ਸਰ ਪਹਿਲਾਂ ਤਾਂ ਮੈਨੂੰ ਰੈਸਟੋਰੈਂਟ ਵਾਲਿਆਂ ਵੱਲੋਂ ਪਰੇਸ਼ਾਨੀ ਦਾ ਝੇਲਣਾ ਪਿਆ ਉਸ ਤੋਂ ਬਾਅਦ ਤੁਹਾਡੀ ਕਸਟਮਰ ਕੇਅਰ ਸਰਵਿਸ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਮਿਲਿਆ ਸਰ ਇਸ ਤਰ੍ਹਾਂ ਨਹੀਂ ਪਲੀਸ ਕਰਨਾ ਚਾਹੀਦਾ ਇਸ ਤਰ੍ਹਾਂ ਤੁਹਾਡਾ ਹੀ ਗ੍ਰਾਹਕ ਖ਼ਰਾਬ ਹੁੰਦਾ ਹੈ ਆਪਾਂ ਕਿਸੇ ਨਾ ਕਿਸੇ ਹੋਰ ਜਗ੍ਹਾ ਤੋਂ ਔਡਰ ਕਰਕੇ ਤਾਂ ਸਮਾਨ ਮੰਗਵਾ ਹੀ ਲਿਆ ਸੀ ਬਟ ਇਸ ਦੇ ਨਾਲ ਤੁਹਾਡੀ ਇਮੇਜ 'ਤੇ ਬਹੁਤ ਫ਼ਰਕ ਪੈਂਦਾ ਹੈ